ਦੇਖੋ ਉਚੇਰੀ ਸਿੱਖਿਆ ਵਿੱਚ ਵਿਗਿਆਨ ਅਤੇ ਗਣਿਤ ਦੋਨਾਂ ਹੀ ਵਿਸ਼ਿਆਂ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਅਜੇ ਵੀ ਜਿਹੜਾ ਵਿਗਿਆਨ ਹੈ ਉਹ ਪੂਰੀ ਤਰ੍ਹਾਂ ਨਾਲ ਆਪਣੇ ਇਸ ਸੌਰ ਮੰਡਲ ਨੂੰ ਸਮਝ ਨਹੀਂ ਪਾਇਆ ਹੈ ਹਰ ਨਵੇਂ ਦਿਨ ਆਪਾਂ ਨੂੰ ਕੋਈ ਨਵੀਂ ਗੱਲ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਨਵੀਂ ਚੀਜ਼ ਸੁਣਨ ਨੂੰ ਮਿਲਦੀ ਸਮਝਣ ਨੂੰ ਮਿਲਦੀ ਹੈ ਤਾਂ ਮੈਂ ਸਮਝਦਾ ਜਦੋਂ ਤੱਕ ਆਪਾਂ ਇਸ ਬ੍ਰਹਿਮੰਡ ਨੂੰ ਜਾਂ ਇਸ ਸੌਰ ਊਰਜਾ ਦੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਆਪਣੇ ਸੌਰ ਮੰਡਲ ਨੂੰ ਇਹਨੂੰ ਸਮਝਣ ਵਾਸਤੇ ਵੀ ਗਿਆਨ ਅਤੇ ਗਣਿਤ ਦੋਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਦੋਂ ਤੱਕ ਆਪਾਂ ਇਸ ਚੀਜ਼ ਨੂੰ ਨਹੀਂ ਸਮਝਾਂਗੇ ਅਸੀਂ ਆਪਣੀ ਹੋਂਦ ਤੱਕ ਨਹੀਂ ਪੁਹੰਚ ਪਾਵਾਂਗੇ ਦੂਸਰਾ ਜਿੱਦਾਂ ਅਗਰ ਆਪਾਂ ਦੁਨਿਆਵੀ ਗੱਲਾਂ ਦੀ ਗੱਲ ਕਰੀਏ ਤਾਂ ਦੁਨਿਆਵੀ ਗੱਲਾਂ ਦੇ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਂਦ ਵਿੱਚ ਆ ਰਹੀ ਹੈ ਉਸ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਸੁਚਾਰੂ ਢੰਗ ਦੇ ਨਾਲ ਲੋਕ ਨਿਰਮਾਣ ਅਤੇ ਲੋਕ ਵਿਕਾਸ ਵਿੱਚ ਚਲਾਉਣ ਲਈ ਸਾਨੂੰ ਵੀ ਵਿਗਿਆਨ ਅਤੇ ਗਣਿਤ ਦੋਨਾਂ ਵਿਸ਼ਿਆਂ ਦੀ ਬਹੁਤ ਭਰਪੂਰ ਮਾਤਰਾ ਦੇ ਨਾਲ ਜ਼ਰੂਰਤ ਪਏਗੀ ਔਰ ਸਿਰਫ ਜ਼ਰੂਰਤ ਹੀ ਨਹੀਂ ਪਏਗੀ ਬਲਕਿ ਇਹਨਾਂ ਦੋਨਾਂ ਵਿਸ਼ਿਆਂ ਵਿੱਚ ਮਹਾਰਤ ਹਾਸਿਲ ਕਰਨ ਦੀ ਜ਼ਰੂਰਤ ਪਵੇਗੀ ਧੰਨਵਾਦ